ਮੇਰੀ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਇਹ ਹੈ ਕਿ ਕਾਲਜ ਦੇ ਵਿੱਚ ਮੈਨੂੰ ਜਿਹੜਾ ਪਬਲਿਕ ਸਪੀਕਰ ਦਾ ਟੈਗ ਦਿੱਤਾ ਗਿਆ ਸੀਗਾ ਉਸਤੋਂ ਬਾਅਦ ਮੈਨੂੰ ਇੱਕ ਐਡੀਟਰ ਦਾ ਟੈਗ ਦਿੱਤਾ ਸੀ ਜਿਹੜਾ ਕਿ ਕਾਮਰਸ ਡਿਪਾਰਟਮੈਂਟ ਵਿੱਚੋਂ ਮੈਂ ਇੰਨੇ ਬੱਚਿਆ ਦੇ ਵਿੱਚੋਂ ਇੱਕ ਇਕੱਲੀ ਕੁੜੀ ਸਿਲੈਕਟ ਹੋਈ ਸੀ ਮੈਨੂੰ ਆਪਣੇ ਪਿਤਾ ਜੀ 'ਤੇ ਬਹੁਤ ਮਾਣ ਹੈ ਕਿ ਉਹਨਾਂ ਨੇ ਮੈਨੂੰ ਮੁੰਡਿਆਂ ਵਾਗ ਹੀ ਪਾਲਿਆ ਹੈ ਅਤੇ ਉਹ ਮੈਨੂੰ ਹਮੇਸ਼ਾ ਹੀ ਮੁੰਡਿਆਂ ਵਾਂਗ ਚੰਗੀਆਂ ਗੱਲਾਂ ਦੱਸਦੇ ਹਨ ਅਤੇ ਜਿਹਦੇ ਨਾਲ ਕਿ ਮੇਰਾ ਬਹੁਤ ਮਨੋਬਲ ਜਿਹੜਾ ਵੱਧਦਾ ਹੈ ਮੈਂ ਇਸ ਗੱਲ ਅਤੇ ਬਹੁਤ ਮਾਣ ਕਰਦੀ ਹਾਂ ਕਿ ਮੈਨੂੰ ਇਹੋ ਜਿਹੇ ਪਿਤਾ ਜੀ ਮਿਲੇ ਹੈ